ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸਾਂ ਜਿਵੇਂ ਕਿ ਤਰਖਾਣ ਦੀ ਪੜ੍ਹਾਈ ਪਲੰਬਰ ਦਾ ਕੰਮ ਸਿਖਲਾਈ ਕਢਾਈ ਦਾ ਕੰਮ ਪੋਲਟਰੀ ਫਾਰਮ ਦਾ ਕੰਮ ਪਸ਼ੂ ਪਾਲਣ ਦਾ ਕੰਮ ਅਤੇ ਹੋਰ ਵੀ ਬਹੁਤ ਸਾਰੇ ਕੀਤੇ ਜਾਂਦੇ ਹਨ ਜਿਨ੍ਹਾਂ ਬਾਰੇ ਪੜ੍ਹਾਇਆ ਜਾਂਦਾ ਹੈ ਕਿ ਪੜ੍ਹਾਉਣਾ ਚਾਹੀਦਾ ਹੈ ਕਿ ਕਿਉਂਕਿ ਜੇ ਇਹਨਾਂ ਕਿੱਤਾ ਮੁਖੀ ਕੋਰਸਾਂ ਦੀ ਪੜ੍ਹਾਈ ਸਕੂਲ ਵਿੱਚ ਹੀ ਕਰਵਾਈ ਜਾਵੇ ਤਾਂ ਸਾਡੇ ਬੱਚੇ ਹੁਨਰਮੰਦ ਬਣ ਜਾਣਗੇ ਅਤੇ ਸਕੂਲ ਤੋਂ ਬਾਅਦ ਕੋਈ ਵੀ ਆਪਣਾ ਰੁਜ਼ਗਾਰ ਚਲਾ ਸਕਦੇ ਹਨ ਆਪਣੇ ਪਰਿਵਾਰ ਨੂੰ ਪਾਲ ਸਕਦੇ ਹਨ ਕੁਝ ਬੱਚੇ ਅਗਰ ਅੱਗੇ ਦੀ ਉਚੇਰੀ ਪੜ੍ਹਾਈ ਵੀ ਕਰਨਾ ਚਾਹੁੰਦੇ ਹੋਣ ਤਾਂ ਉਹ ਵੀ ਕੋਈ ਵੀ ਕਿੱਤਾ ਮੁਖੀ ਕੋਰਸ ਚੁਣ ਕੇ ਅੱਗੇ ਕਾਲਜ ਵਿੱਚ ਪੜ੍ਹ ਕੇ ਇੰਜੀਨੀਅਰ ਵੀ ਬਣ ਸਕਦੇ ਹਨ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਦੇ ਸਨ ਅਤੇ ਉੱਚੀਆਂ ਪਦਵੀਆਂ 'ਤੇ ਵੀ ਜਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਹਨ ਕਿਉਂਕਿ ਮੈਂ ਸੋਚਦੀ ਹਾਂ ਕਿ ਜਿਹੜਾ ਹੁਨਰ ਅਸੀਂ ਆਪਣੇ ਹੱਥੀਂ ਸਿੱਖਦੇ ਹਾਂ ਉਹ ਹੁਨਰ ਸਦਾ ਸਾਡੇ ਨਾਲ ਰਹਿੰਦਾ ਹੈ ਅਤੇ ਅਤੇ ਅਸੀਂ ਜ਼ਿੰਦਗੀ ਵਿੱਚ ਕਦੀ ਵੀ ਅਸਫਲ ਨਹੀਂ ਹੋ ਸਕਦੇ ਅਤੇ ਇਸ ਲਈ ਕਿੱਤਾ ਮੁਖੀ ਕੋਰਸਾਂ ਨੂੰ ਸਕੂਲ ਵਿੱਚ ਹੀ ਪੜ੍ਹਾਇਆ ਪੜ੍ਹਾਇਆ ਜਾਣਾ ਚਾਹੀਦਾ ਹੈ